ਮੈਂ ਸ਼ਿਮਲਾ ਡਲਹੋਜੀ ਮੈਕਲੋਡਗੰਜ ਵਰਗੀਆਂ ਕੁਦਰਤੀ ਪਹਾੜੀ ਸਥਾਨਾਂ 'ਤੇ ਘੁੰਮਣ ਵਾਸਤੇ ਗਈ ਪਰ ਇਹਨਾਂ ਦੇ ਵਿੱਚੋਂ ਮੈਨੂੰ ਜੋ ਬਹੁਤ ਵਧੀਆ ਲੱਗਾ ਉਹ ਹੈ ਮੈਕਲੋਡਗੰਜ ਅਤੇ ਇੱਥੇ ਕੁਦਰਤੀ ਵਾਤਾਵਰਣ ਨੂੰ ਮਾਣਦਿਆਂ ਹੋਇਆਂ ਮੈਂ ਆਪਣੀ ਮੈਂ ਇੱਕ ਜਦੋਂ ਗਈ ਤਾਂ ਮੈਂ ਇਹੀ ਸੋਚਿਆ ਕਿ ਮੈਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਉੱਥੋਂ ਦੀ ਜੋ ਕੁਦਰਤ ਹੈ ਉਹਨੂੰ ਮਾਣਦਿਆਂ ਹੋਇਆ ਮੈਂ ਰੁਟੀਨ ਬਣਾਈ ਕਿ ਮੈਂ ਸਵੇਰ ਤੋਂ ਕਿੰਨੇ ਸਮੇਂ ਸਮਾਂ ਬੰਨਿਆ ਅਤੇ ਜਿਹਦੇ ਵਾਸਤੇ ਮੈਂ ਆਪਣਾ ਸਮਾਂ ਲਗਾਇਆ ਯੋਗਾ ਦੇ ਵਿੱਚ ਕਿਉਂਕਿ ਵਧੀਆ ਵਾਤਾਵਰਣ ਹੋਣ ਕਰਕੇ ਆਸੇ ਪਾਸੇ ਚਹਿਲ ਪਹਿਲ ਵੀ ਸਿਰਫ ਸੀ ਤਾਂ ਉਹ ਵੀ ਕੁਦਰਤੀ ਪੰਛੀਆਂ ਦੀ ਪੰਛੀਆਂ ਦੀ ਚਹਿਲ ਪਹਿਲ ਇੱਥੋਂ ਦੇ ਦੁਨੀਆਂਦਾਰੀ ਦੇ ਜਿਹੜੇ ਰੌਲਾ ਕਾਰਾਂ ਦੇ ਹੋਰਨ ਬੱਸਾਂ ਦੇ ਹੋਰਨ ਇਹਨਾਂ ਤੋਂ ਮੁਕਤ ਯਾਤਰਾ ਸੀ ਮੁਕਤ ਸਥਾਨ ਸੀ ਅਤੇ ਇਸੇ ਵਿੱਚ ਹੀ ਮੈਨੂੰ ਇਹ ਯਾਤਰਾ ਜਿਹੜੀ ਹੈ ਬਹੁਤ ਵਧੀਆ ਲੱਗੀ